ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਅੱਛਾ ਭਾਅ ਜੀ ਵੈਸੇ ਤਾਂ ਭਾਅ ਜੀ ਪੰਜਾਬ 'ਚ ਬਹੁਤ ਸਾਰੇ ਫੇਮਸ ਫੂਡਜ਼ ਹਨ ਸੀਗ ਦੀ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਅਤੇ ਲੱਸੀ ਦਾ ਗਿਲਾਸ ਇਹ ਭਾਅ ਜੀ ਟੋਪ ਦਾ ਫੂਡ ਆ ਪੰਜਾਬ 'ਚ ਸਭ ਤੋਂ ਜ਼ਿਆਦਾ ਇਹੀ ਖਾਇਆ ਜਾਂਦਾ ਹੈ ਅਤੇ ਸਭ ਤੋਂ ਵਧੀਆ ਫੂਡ ਹੈ ਪੰਜਾਬ 'ਚ ਸਰਦੀਆਂ ਵਾਸਤੇ ਹਾਂਜੀ ਫਿਰ ਇਹ ਤਾਂ ਦੱਸੇ ਬਾਬਾ ਜੀ ਤੁਹਾਨੂੰ ਪੰਜਾਬ 'ਚ ਬਹੁਤ ਤਰ੍ਹਾਂ ਦੇ ਪਰੌਂਠੇ ਬਣਦੇ ਆ ਆਲੂ ਦੇ ਪਰੌਂਠੇ ਗੋਭੀ ਦੇ ਪਰੌਂਠੇ ਮੂਲੀ ਦੇ ਪਰੌਂਠੇ ਪਨੀਰ ਦੇ ਪਰੌਂਠੇ ਬਹੁਤ ਤਰ੍ਹਾਂ ਦੇ ਪਰੌਂਠੇ ਵੀ ਬਣਦੇ ਹਨ ਉਹ ਵੀ ਅਲੱਗ ਅਲੱਗ ਚੱਟਨੀਆਂ ਨਾਲ ਹਾਂਜੀ ਉਹਦੇ ਉੱਪਰ ਵੀ ਮੱਖਣ ਲਾ ਕੇ ਖਾਣ ਦਾ ਅਲੱਗ ਏ ਸਵਾਦ ਆਉਂਦਾ ਭਾਅ ਜੀ ਅਤੇ ਉਹ ਤੋਂ ਬਾਅਦ ਫਿਰ ਹੋਰ ਤੁਹਾਨੂੰ ਦਾਲ ਮੱਖਣੀ ਹੋ ਗਈ ਇਹ ਭਾਅ ਜੀ ਬਹੁਤ ਵਧੀਆ ਇਹ ਬਹੁਤ ਚੱਲਦੀ ਆ ਪੰਜਾਬ 'ਚ

ਹਾਂਜੀ ਭਾਅ ਜੀ ਮੈਂ ਘੁੰਮਾ ਫਿਰਾ ਦੂੰਗਾ ਤੁਸੀਂ ਜਦ ਮਰਜ਼ੀ ਆਓ ਸਾਡੇ ਕੋਲ ਮੋਸਟ ਵੈਲਕਮ ਭਾਅ ਜੀ ਤੁਹਾਡਾ ਤੁਸੀਂ ਕਿੱਥੋਂ ਚੰਡੀਗੜ੍ਹ ਤੋਂ ਆਉਂਗੇ ਤੁਸੀਂ ਜਦ ਮਰਜ਼ੀ ਆਓ ਭਾਅ ਜੀ ਮੈਨੂੰ ਇੱਕ ਵਾਰੀ ਕੋਲ ਜ਼ਰੂਰ ਕਰ ਦਿਓ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਹਰੇਕ ਜਗ੍ਹਾ ਘੁੰਮਾਊਂਗਾ ਵਧੀਆ ਖਾਣ ਪੀਣ ਦੀਆਂ ਚੀਜ਼ਾਂ ਤੁਹਾਨੂੰ ਨਿਊ ਨਿਊ ਚੀਜ਼ਾਂ ਟਰਾਈ ਕਰਵਾਉਂਗਾ ਪੰਜਾਬ ਦੀਆਂ ਫੇਮਸ ਚੀਜ਼ਾਂ ਪੰਜਾਬ 'ਚ ਅਲੱਗ ਅਲੱਗ ਫੇਮਸ ਜਗ੍ਹਾਵਾਂ ਜਿਹੜੇ ਖਾਣ ਪੀਣ 'ਚ ਵਧੀਆ ਦੁਕਾਨਾਂ ਹੈਗੀਆਂ ਉੱਥੇ ਵਿਜਿਟ ਕਰਾਉਂਗਾ ਭਾਅ ਜੀ ਤੁਹਾਨੂੰ ਮੈਂ ਭਾਅ ਜੀ ਮੈਂ ਤਾਂ ਫਰੀ ਹੈ ਤੁਸੀਂ ਜਦ ਮਰਜ਼ੀ ਆ ਜਿਓ ਮੈਨੂੰ ਬਸ ਇੱਕ ਵਾਰੀ ਆ ਕੇ ਕੋਲ ਕਰ ਲਿਓ ਕੋਈ ਗੱਲ ਨਹੀਂ ਭਾਅ ਜੀ ਤੁਸੀਂ ਮੈਨੂੰ ਜਦ ਮਰਜ਼ੀ ਕਰ ਲਿਓ ਫਿਰ ਮੈਂ ਅਸੀਂ ਤੁਸੀਂ ਮੈਂ ਤੁਹਾਨੂੰ ਰਿਸੀਵ ਕਰ ਲਉਂਗਾ ਅਸੀਂ ਵਧੀਆ ਵਧੀਆ ਦੁਕਾਨਾਂ 'ਤੇ ਮੈਂ ਤੁਹਾਨੂੰ ਵਿਜਿਟ ਕਰਾਉਂਗਾ ਤੁਸੀਂ ਖਾ ਪੀ ਕੇ ਆਪ ਰਿਵਿਊ ਚੈੱਕ ਕਰਿਓ ਅਤੇ ਉਹ ਤੋਂ ਬਾਅਦ ਪਬਲਿਕ ਨੂੰ ਦੱਸਿਓ ਵੀ ਇਹ ਕਿੱਦਾਂ ਦਾ ਹੈਗਾ ਵੈਸੇ ਤਾਂ ਪੰਜਾਬ ਦਾ ਖਾਣਾ ਸਭ ਤੋਂ ਬੈਸਟ ਹੁੰਦਾ ਭਾਅ ਜੀ ਓਕੇ ਭਾਅ ਜੀ ਜਦ ਮਰਜ਼ੀ ਆ ਜਿਓ ਓਕੇ ਭਾਅ ਜੀ